ਮੈਨੂੰ ਲਿਖਣਾ ਬਹੁਤ ਹੀ ਪਸੰਦ ਹੈ ਪਸੰਦ ਹੈ ਮੈਂ ਆਪਣੀ ਲਾਈਫ਼ ਡਾਇਰੀ ਵਿੱਚ ਵੀ ਲਿਖਦੀ ਰਹਿੰਦੀ ਸ ਰਹਿੰਦੀ ਹਾਂ ਜਦ ਵੀ ਕੋਈ ਅਖ਼ਬਾਰ ਵਿੱਚ ਕੋਈ ਨਿਊਜ਼ ਜਾਂ ਟੋਪਿਕ ਆਉਂਦਾ ਹੈ ਤਾਂ ਮੈਂ ਉਹ ਵੀ ਕੋਪੀ ਵਿੱਚ ਲਿਖ ਲੈਂਦੀ ਹਾਂ ਮੈਨੂੰ ਲਿਖਣਾ ਬਹੁਤ ਹੀ ਪਸੰਦ ਹੈ ਪਹਿਲੇ ਜ਼ਮਾਨੇ ਵਿੱਚ ਤਾਂ ਲੋਕ ਕਾਪੀਆਂ ਅਤੇ ਸਲੇਟਾਂ ਪਰ ਲਿਖਦੇ ਹੁੰਦੇ ਸੀ ਇਸ ਵਾਰ ਤਾਂ ਲੋਕ ਇੰਟਰਨੈੱਟ 'ਤੇ ਫੋਨਾਂ ਵਿੱਚ ਹੀ ਟਾਈਪ ਕਰਕੇ ਰੱਖ ਸੇਵ ਕਰਕੇ ਰੱਖ ਲੈਂਦੇ ਹਨ ਮੈਨੂੰ ਲਿਖਣਾ ਤਾਂ ਬਹੁਤ ਹੀ ਪਸੰਦ ਹੈ ਮੈਂ ਜਦੋਂ ਵੀ ਮੇਰਾ ਦਿਲ ਕਰਦਾ ਹੈ ਮੈਂ ਫੋਨ ਵਿੱਚ ਟਾਈਪ ਕਰਕੇ ਉਸਨੂੰ ਸੇਵ ਕਰਕੇ ਰੱਖ ਲੈਂਦੀ ਹਾਂ ਮੈਨੂੰ ਲਿਖਣ ਲਿਖਣਾ ਤਾਂ ਬਹੁਤ ਹੀ ਇੰਨਾਂ ਪਸੰਦ ਹੈ ਕਿ ਮੈਂ ਜਦ ਵੀ ਮੇਰੇ ਹੱਥ ਵਿੱਚ ਫ਼ੋਨ ਹੁੰਦਾ ਹੈ ਤਾਂ ਮੈਂ ਟਾਈਪ ਕਰਦੀ ਰਹਿੰਦੀ ਹਾਂ